ਅੱਜ ਜਦੋਂ ਸਵੇਰੇ ਮੈਂ ਪਾਣੀ ਭਰਨ ਲਈ ਨਲ ਚਲਾਇਆ ਤਾਂ ਨਲ ਤੋਂ ਪਰਵਾਹ ਅਸਧਾਰਨ ਤੌਰ 'ਤੇ ਹੌਲੀ ਸੀ ਮੈਂ ਇਸ ਦੀ ਜਾਂਚ ਕਰਨ ਲਈ ਜਲ ਅਥਾਰਟੀ ਆਫਿਸ ਗਈ ਅਤੇ ਉਹਨਾਂ ਨੂੰ ਸਮੱਸਿਆ ਬਾਰੇ ਦੱਸਿਆ ਮੈਨੂੰ ਉਹਨਾਂ ਤੋਂ ਪਤਾ ਲੱਗਿਆ ਕਿ ਪਾਣੀ ਨੂੰ ਸਾਫ਼ ਕਰਨ ਲਈ ਪਾਣੀ ਵਿਚ ਦਵਾਈ ਸੁੱਟੀ ਗਈ ਹੈ ਜਿਸ ਕਾਰਨ ਪਾਣੀ ਘੱਟ ਮਾਤਰਾ ਵਿੱਚ ਪਰਵਾਹ ਕੀਤਾ ਜਾ ਰਿਹਾ ਹੈ ਹੈ ਅਤੇ ਉਹਨਾਂ ਨੇ ਜਲਦ ਹੀ ਇਸ ਸਮੱਸਿਆ ਦਾ ਨਿਪਟਾਰਾ ਕਰਨ ਦਾ ਵੀ ਵਾਅਦਾ ਕੀਤਾ ਅਤੇ ਮੈਂ ਵੀ ਉਹਨਾਂ ਦਾ ਪੂਰਾ ਪੂਰਾ ਸਾਥ ਦੇਣ ਦਾ ਵਾਅਦਾ ਕੀਤਾ ਅਤੇ ਪਾਣੀ ਦੀ ਵਰਤੋਂ ਠੀਕ ਢੰਗ ਨਾਲ ਕਰਨਾ ਅਤੇ ਪਾਣੀ ਨੂੰ ਫਾਲਤੂ ਬਰਬਾਦ ਨਾ ਕਰਨ ਦਾ ਫੈਸਲਾ ਲਿੱਤਾ